ਪੰਜਾਬੀ ਭਾਸ਼ਾ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਜਵਾਕ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਉੱਥੇ ਇੰਗਲਿਸ਼ ਬੋਲੀ ਜਾਂਦੀ ਹੈ ਅਤੇ ਉੱਥੇ ਪੰਜਾ ਪੰਜਾਬੀ ਛੇਵੀਂ ਪੰਜਵੀਂ ਛੇਵੀਂ ਤੋਂ ਹੀ ਸਟਾਰਟ ਹੁੰਦੀ ਹੈ ਅਤੇ ਉਹ ਆਪਣੀ ਮਾਂ ਪ ਬੋਲੀ ਨੂੰ ਭੁੱਲ ਜਾਂਦੇ ਆ ਜੇ ਅਸੀਂ ਕਿਤੇ ਬਾਹਰ ਰਹਿੰਦੇ ਉੱਥੇ ਇੰਗਲਿਸ਼ ਜਾਂ ਹਿੰਦੀ ਬੋਲੀ ਜਾਂਦੀ ਆ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਆ ਇਸ ਕਰਕੇ ਲੋਕ ਸਰਕਾਰੀ ਨੌਕਰੀਆਂ ਭਾਲਦੇ ਆ ਅਤੇ ਸਰਕਾਰੀ ਨੌਕਰੀਆਂ 'ਚ ਪੰਜਾਬੀ ਜ਼ਿਆਦਾ ਆਉਂਦੀ ਆ ਅਤੇ ਪ੍ਰਾਈਵੇਟ ਜਿਹੜੇ ਪ ਸਰਕਾਰੀ ਸਕੂਲ ਆ ਉੱਥੇ ਆਪਣੀ ਮਾਂ ਬੋਲੀ ਹੀ ਬੋਲੀ ਜਾਂਦੀ ਹੈ ਪੰਜਾਬੀ ਅਤੇ ਪ੍ਰਾਈਵੇਟ ਸਕੂਲਾਂ 'ਚ ਇੰਗਲਿਸ਼ ਬੋਲੀ ਜਾਂਦੀ ਆ ਜਾਂ ਹਿੰਦੀ ਅਤੇ ਇਸ ਕਰਕੇ ਸਾਨੂੰ ਪੰਜਾਬੀ ਵਾਲੇ ਲੋਕ ਸਰਕਾਰੀ ਨੌਕਰੀਆਂ ਭਾਲਦੇ ਆ ਅਤੇ ਪੰਜਾਬੀ ਬੋਲਣ 'ਚ ਜਵਾਕ ਇੰਗਲਿਸ਼ ਬੋਲਦੇ ਆ ਅਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਕਿ ਸ ਅਸੀਂ ਸਰਕਾਰੀ ਨੌਕਰੀ ਅ ਪ ਪ੍ਰਾਈਵੇਟ ਇੰਗਲਿਸ਼ ਬੋਲਣ ਨਾਲ ਪ੍ਰਾਈਵੇਟ ਨੌਕਰੀਆਂ ਮਿਲਦੀਆਂ ਅਤੇ ਅਸੀਂ ਆਪਣੀ ਮਾਂ ਬੋਲੀ ਨੂੰ ਨਹੀਂ ਭ ਭਲਾਉਣਾ